ਹਾਂ ਸਿੱਖਿਅਤ ਵਿਅਕਤੀ ਜਿਹੜਾ ਹੁੰਦਾ ਆ ਉਹ ਚੰਗੇ ਵਿਚਾਰਾਂ ਵਾਲਾ ਹੁੰਦਾ ਤਾਂ ਸਿਧਾਂਤਾਂ ਦੀ ਪਾਲਣ ਵੀ ਕਰਦਾ ਹੈ ਕਿਉਂਕਿ ਉਹਨੇ ਕਿਤਾਬਾਂ ਪੜ੍ਹੀਆਂ ਹੋਈਆਂ ਨੇ ਅਤੇ ਪੜ੍ਹਦੇ ਪੜ੍ਹਦੇ ਉਹਨਾਂ ਦੇ ਵਿੱਚ ਉਹਨੂੰ ਮੋਰਲ ਵੈਲਿਊਸ ਵੀ ਪਤਾ ਲੱਗ ਜਾਂਦੀਆਂ ਨੇ ਤਾਂ ਇਸ ਲਈ ਉਹ ਸਹੀ ਸਿਧਾਂਤਾਂ ਦੀ ਪਾਲਣ ਕਰਦਾ ਹੈ